ਪਿਛਲੇ ਹਫ਼ਤੇ ਫਲਿੱਪਕਾਰਟ ਤੋਂ ਮੈਂ ਜੁੱਤੀ ਮੰਗਵਾਈ ਸੀ ਲੋਫਰ ਦੀ ਅਤੇ ਜੁੱਤੀ ਮੈਨੂੰ ਫਿੱਟ ਵੀ ਬੈਠ ਗਈ ਮੇਰੇ ਪੈਰ ਨੂੰ ਅਤੇ ਮੈਨੂੰ ਪਾਉਣ ਵਿੱਚ ਵੀ ਕੋਈ ਦਿੱਕਤ ਨਹੀਂ ਆ ਰਹੀ ਬਹੁਤ ਵਧੀਆ ਲੱਗਦੀ ਅਤੇ ਉਦੋਂ ਪਾਈ ਵੀ ਸੋਹਣੀ ਲੱਗਦੀ